ਸਾਡੇ ਖੇਤਰ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਜਿਵੇਂ ਕਿ ਕਬੱਡੀ ਫੁੱਟਬਾਲ ਕ੍ਰਿਕਟ ਬਹੁਤ ਖੇਡੀਆਂ ਜਾਂਦੀਆਂ ਹਨ ਥਾਵਾਂ ਥਾਵਾਂ 'ਤੇ ਇਹਨਾਂ ਦੇ ਮੈਚ ਹੁੰਦੇ ਹਨ ਜਿਵੇਂ ਕਿ ਜ਼ਿਆਦਾਤਰ ਫੁੱਟਬਾਲ ਅਤੇ ਕ੍ਰਿਕਟ ਅਤੇ ਕਬੱਡੀ ਇਹੀ ਫੇਮਸ ਨੇ ਮਸ਼ਹੂਰ ਨੇ ਅਤੇ ਇਹਨਾਂ ਖੇਡਾਂ ਨੂੰ ਅਸੀਂ ਜਿਵੇਂ ਕਿ ਤੁਸੀਂ ਲਾ ਲਉ ਕ੍ਰਿਕਟ ਨੂੰ ਲਾ ਲਉ ਕ੍ਰਿਕਟ ਵਿੱਚ ਦੋ ਟੀਮਾਂ ਹੁੰਦੀਆਂ ਨੇ ਅਤੇ ਗਿਆਰ੍ਹਾਂ ਗਿਆਰ੍ਹਾਂ ਪਲੇਅਰ ਹੁੰਦੇ ਨੇ ਇੱਕ ਸਾਈਡ ਅਤੇ ਅੰਪੇਅਰ ਹੁੰਦਾ ਏ ਜਿਵੇਂ ਕਿ ਅੰਪੇਅਰ ਦਾ ਫੈਸਲਾ ਅਟੱਲ ਹੈ ਸੁਣਿਆ ਹੋਵੇਗਾ ਤੁਸੀਂ ਅਤੇ ਉਹ ਸਾਰੇ ਫੈਸਲੇ ਦਿੰਦਾ ਏ ਜਿਵੇਂ ਜੇ ਬਾਲ ਗੇਂਦ ਬਾਊਂਡਰੀ ਤੋਂ ਉੱਪਰ ਦੀ ਲੰਘ ਜਾਂਦੀ ਹੈ ਤਾਂ ਛਿੱਕਾ ਹੋ ਜਾਂਦਾ ਹੈ ਜੇ ਰੁੜ ਕੇ ਜਾਂਦੀ ਹੈ ਤਾਂ ਚੌਕਾ ਅਤੇ ਇੱਕ ਹੋਰ ਰਹੱਸਮਈ ਗੱਲ ਇਹ ਹੈ ਕਿ ਛੋਟੇ ਬੱਚੇ ਦੁੱਕਾ ਵੀ ਬਣਾ ਲੈਂਦੇ ਨੇ ਉਹ ਨੇੜੇ ਵਾਲੇ ਹੁੰਦੇ ਆ ਜਿਹੜੇ ਉਹ ਦੁੱਕਾ ਕਹਿ ਦਿੰਦੇ ਨੇ ਇਸ ਤਰ੍ਹਾਂ ਅਸੀਂ ਖੇਡ ਨੂੰ ਖੇਡਦੇ ਹਾਂ